ਸਤਿ ਸ਼੍ਰੀ ਅਕਾਲ ਜੀ ਕੁਝ ਸਮਿਆਂ ਤੋਂ ਆਮ ਗਲਤੀਆਂ ਇਹ ਹਨ ਜੋ ਬਾਈਕ ਚਲਾਉਂਦੇ ਹਨ ਰੋਂਗ ਸਾਈਡ ਚਲਾਉਂਦੇ ਹਨ ਅਤੇ ਸੜਕ 'ਤੇ ਸਟੰਟ ਵਗੈਰਾ ਕਰਦੇ ਹਨ ਉਸ ਨਾਲ ਬਹੁਤ ਹੀ ਭਿਆਨਕ ਐਕਸੀਡੈਂਟ ਹੋ ਸਕਦਾ ਹੈ ਅਤੇ ਕੁਝ ਲੋਕ ਬੱਤੀਆਂ ਦਾ ਇਸਤੇਮਾਲ ਨਹੀਂ ਕਰਦੇ ਬੱਤੀਆਂ ਕਰੋਸ ਕਰ ਜਾਂਦੇ ਹਨ ਉਸ ਨਾਲ ਵੀ ਗਲਤ ਉਸ ਨਾਲ ਵੀ ਗਲਤ ਅਤੇ ਹੋ ਜਾਂਦਾ ਹੈ ਰੋਂਗ ਸਾਈਡ ਬਾਈਕ ਨਹੀਂ ਚਲਾਉਣੀ ਚਾਹੀਦੀ ਜਦੋਂ ਰੋਂਗ ਸਾਈਡ ਬਾਈਕ ਚਲਾਉਂਦੇ ਹਾਂ ਤਾਂ ਦੁਰਘਟਨਾ ਹੋਣ ਦਾ ਡਰ ਰਹਿੰਦਾ ਹੈ ਬਾਈਕ ਨੂੰ ਸਿੱਧਾ ਹੀ ਚਲਾਉਣਾ ਚਾਹੀਦਾ ਹੈ ਅਤੇ ਸੜਕ 'ਤੇ ਸਟੰਟ ਵਗੈਰਾ ਨਹੀਂ ਕਰਨੇ ਚਾਹੀਦੇ ਅਤੇ ਬਾਈਕ ਨੂੰ ਬਾਈਕ ਨੂੰ ਹਮੇਸ਼ਾ ਪਟਰੋਲ ਪਾ ਕੇ ਰੱਖਣਾ ਚਾਹੀਦਾ ਹੈ ਜਿਸ ਨਾਲ ਕਿ ਉਹ ਸੜਕ ਵਗੈਰਾ 'ਤੇ ਨਾ ਰੁਕੇ ਜੇਕਰ ਪਟਰੋਲ ਨਾ ਪਾਵਾਂਗੇ ਤਾਂ ਉਹ ਕਿਤੇ ਵੀ ਰੁੱਕ ਸਕਦਾ ਹੈ

ਬਾਈਕ ਨੂੰ ਚਲਾਉਂਦੇ ਸਮੇਂ ਸਾਨੂੰ ਬਹੁਤ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸਾਨੂੰ ਤਿੰਨ ਜਣਿਆਂ ਤੋਂ ਵੱਧ ਨਹੀਂ ਬਿਠਾਉਣਾ ਚਾਹੀਦਾ ਅਤੇ ਇਸਦੀ ਰੇਸ ਵੀ ਮੀਡੀਅਮ ਹੋਣੀ ਚਾਹੀਦੀ ਹੈ ਜ਼ਿਆਦਾ ਰੇਸ ਨਹੀਂ ਕਰਨੀ ਚਾਹੀਦੀ ਇਸ ਨਾਲ ਵੀ ਦੁਰਘਟਨਾ ਹੋਣ ਦਾ ਡਰ ਰਹਿੰਦਾ ਹੈ ਅਤੇ ਇਸਦੇ ਕੁਝ ਨਿਯਮ ਹਨ ਜੋ ਕਿ ਸਾਨੂੰ ਇਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਸਾਨੂੰ ਸੜਕ 'ਤੇ ਹਮੇਸ਼ਾ ਬਾਈਕ ਹੌਲੀ ਚਲਾਉਣੀ ਚਾਹੀਦੀ ਹੈ ਜ਼ਿਆਦਾ ਤੇਜ਼ ਨਹੀਂ ਚਲਾਉਣੀ ਚਾਹੀਦੀ ਅਤੇ ਇਸ ਵਿੱਚ ਪਟਰੋਲ ਵੀ ਪੁਆਉਣਾ ਚਾਹੀਦਾ ਹੈ ਜਿੰਨੀ ਕੁ ਸਾਨੂੰ ਲੋੜ ਮੁਤਾਬਕ ਪੁਆਉਣਾ ਚਾਹੀਦਾ ਹੈ ਇਸ ਵਿੱਚ ਘੱਟ ਨਹੀਂ ਹੋਣਾ ਚਾਹੀਦਾ ਜ਼ਿਆਦਾ ਤੇਜ਼ ਇਸਨੂੰ ਨਹੀਂ ਚਲਾਉਣਾ ਚਾਹੀਦਾ ਸੜਕ 'ਤੇ ਸਾਨੂੰ ਕੋਈ ਵੀ ਸਟੰਟ ਵਗੈਰਾ ਨਹੀਂ ਕਰਨਾ ਚਾਹੀਦਾ ਜੇਕਰ ਅਸੀਂ ਸਟੰਟ ਕਰਦੇ ਹਾਂ ਤਾਂ ਦੁਰਘਟਨਾ ਹੋਣ ਦਾ ਡਰ ਰਹਿੰਦਾ ਹੈ ਸੜਕ 'ਤੇ ਸਾਨੂੰ ਹਮੇਸ਼ਾ ਇੱਧਰ ਉੱਧਰ ਦੇਖ ਕੇ ਹੀ ਸੜਕ ਕਰੋਸ ਕਰਨੀ ਚਾਹੀਦੀ ਹੈ ਜੇਕਰ ਜੇਕਰ ਕੋਈ ਵੱਡੀ ਚੀਜ਼ ਵਗੈਰਾ ਆਉਂਦੀ ਹੈ ਤਾਂ ਸਾਨੂੰ ਇੱਕ ਵਾਰ ਰੁੱਕ ਜਾਣਾ ਚਾਹੀਦਾ ਹੈ ਜ਼ਿਆਦਾ ਤੇਜ਼ ਬਾਈਕ ਨਹੀਂ ਚਲਾਉਣੀ ਚਾਹੀਦੀ ਬਾਈਕ ਨੂੰ ਹਮੇਸ਼ਾ ਬਾਈਕ ਨੂੰ ਹਮੇਸ਼ਾ ਸਲੋਅ 'ਤੇ ਚਲਾਉਣਾ ਚਾਹੀਦਾ ਹੈ ਬੱਤੀਆਂ ਦਾ ਇਸਤੇਮਾਲ ਕਰਨੀ ਚਾਹੀਦਾ ਜੇਕਰ ਬੱਤੀ ਹੋ ਜਾਵੇ ਤਾਂ ਸਾਨੂੰ ਓਥੇ ਹੀ ਰੁੱਕ ਜਾਣਾ ਚਾਹੀਦਾ ਹੈ